ਮੈਂ ਆਪਣਾ ਪਹਿਲਾ ਪ੍ਰੋਡਕਟ ਫਲਿਪਕਾਰਡ ਤੋਂ ਆਰਡਰ ਕੀਤਾ ਸੀ ਜੋ ਕਿ ਹੈਡਫੋਨ ਸਨ ਮੈਨੂੰ ਉਹ ਹਜ਼ਾਰ ਰੁਪਏ ਵਿੱਚ ਪਏ ਸਨ ਅਤੇ ਉਹਨਾਂ ਹੈਡਫੋਨਾਂ ਦੀ ਡਿਲੀਵਰੀ ਮੈਨੂੰ ਇੱਕ ਹਫਤੇ 'ਚ ਹੋਈ ਸੀ ਜਦੋਂ ਉਹ ਹੈਡਫੋਨ ਮੈਨੂੰ ਮਿਲੇ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਹੈਡਫੋਨ ਬਹੁਤ ਵਧੀਆ ਸੀ ਉਸ ਦੀ ਆਵਾਜ਼ ਵੀ ਬਹੁਤ ਵਧੀਆ ਸੀ ਉਸ ਦੀ ਬੈਟਰੀ ਵੀ ਜਲਦੀ ਨਹੀਂ ਸੀ ਮੁੱਕਦੀ ਮੈਂ ਹੈਡਫੋਨ ਦੋ ਦਿਨ ਤੱਕ ਲਗਾਤਾਰ ਵਰਤੋਂ ਕੀਤੀ ਅਤੇ ਉਸ ਦੀ ਬੈਟਰੀ ਵੀ ਨਹੀਂ ਘਟੀ ਪਰ ਜਿਹੜੇ ਮੇਰੇ ਕੋਲ ਪਹਿਲਾਂ ਹੈਡਫੋਨ ਸਨ ਉਸ ਦੀ ਬੈਟਰੀ ਬਹੁਤ ਹੀ ਜਲਦੀ ਘੱਟ ਜਾਂਦੀ ਸੀ ਜਿਸ ਕਰਕੇ ਮੈਂ ਇਹ ਹੈਡਫੋਨ ਆਰਡਰ ਕੀਤੇ ਸਨ ਜਿਹੜਾ ਡਿਲੀਵਰੀ ਬੋਆਏ ਮੈਨੂੰ ਇਹ ਹੈਡਫੋਨ ਦੇਣ ਆਇਆ ਸੀ ਉਸ ਦਾ ਸੁਭਾਅ ਵੀ ਬਹੁਤ ਚੰਗਾ ਸੀ ਉਸ ਨੇ ਮੇਰੇ ਨਾਲ ਬਹੁਤ ਹੀ ਵਿਨਮਰਤਾ ਨਾਲ ਗੱਲ ਕੀਤੀ ਜਿਸ ਨਾਲ ਮੇਰਾ ਮਨ ਬਹੁਤ ਖੁਸ਼ ਹੋਇਆ ਅਤੇ ਮੈਨੂੰ ਇਸ ਵਿੱਚ ਗਾਣੇ ਸੁਣਨ ਦਾ ਵੀ ਬਹੁਤ ਆਨੰਦ ਆਉਂਦਾ ਹੈ ਇਸ ਦੀ ਆਵਾਜ਼ ਮੇਰੇ ਦਿਲ ਨੂੰ ਖੁਸ਼ ਕਰ ਦਿੰਦੀ ਹੈ ਜਦ ਮੈਂ ਇਹ ਹੈਡਫੋਨ ਲਾਉਂਦਾ ਹਾਂ ਅਤੇ ਮੈਨੂੰ ਬਾਹਰ ਦੀ ਆਵਾਜ਼ ਨਹੀਂ ਸੁਣਦੀ ਇਸ ਵਿੱਚ ਕਾਲਿੰਗ ਵੀ ਬਹੁਤ ਵਧੀਆ ਹੋ ਜਾਂਦੀ ਹੈ ਜਿਸ ਨਾਲ ਮੈਂ ਜੇਕਰ ਆਪਣੀ ਗੱਡੀ ਚਲਾਉਂਦਾ ਹਾਂ ਅਤੇ ਮੈਨੂੰ ਫ਼ੋਨ ਚੁੱਕਣ ਦੀ ਵੀ ਲੋੜ ਨਹੀਂ ਪੈਂਦੀ ਇਸ ਕਰਕੇ ਇਹ ਹੈਡਫੋਨ ਮੈਨੂੰ ਬਹੁਤ ਹੀ ਵਧੀਆ ਲੱਗੇ ਜਿਹੜਾ ਡਿਲੀਵਰੀ ਬੋਆਏ ਇਹ ਆਰਡਰ ਦੇਣ ਆਇਆ ਸੀ ਉਸਨੇ ਮੈਨੂੰ ਦੱਸਿਆ ਕਿ ਇਹ ਹੈਡਫੋਨ ਬਹੁਤ ਹੀ ਜਾਣਿਆ ਦੀ ਪਸੰਦ ਬਣ ਚੁੱਕੇ ਹਨ ਅਤੇ ਬਹੁਤ ਹੀ ਜਲਦੀ ਹੋਰ ਵੀ ਆਰਡਰ ਮੈਂ ਹੋਰ ਦੇਣ ਜਾ ਰਿਹਾ ਹਾਂ ਧੰਨਵਾਦ